ਸਿੱਖਿਆ ਹਰ ਇਨਸਾਨ ਦਾ ਮੁੱਢਲਾ ਹੱਕ ਹੈ ਹਰ ਇਨਸਾਨ ਹਰ ਬੱਚੇ ਅਤੇ ਹਰ ਵਰਗ ਦੇ ਲੋਕਾਂ ਤੱਕ ਸਿੱਖਿਆ ਨੂੰ ਪਹੁੰਚਾਉਣ ਲਈ ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਚੰਗੇ ਕਦਮ ਉਠਾ ਰਹੇ ਹਨ

ਇਸ ਤੋਂ ਇਲਾਵਾ ਸਰਕਾਰੀ ਸਕੂਲਾਂ ਦੇ ਵਿੱਚ ਫੀਸ ਵੀ ਬਹੁਤ ਥੋੜ੍ਹੀ ਜਾਂ ਨਾ ਮਾਤਰ ਰੱਖੀ ਜਾਂਦੀ ਹੈ ਤਾਂ ਜੋ ਹਰ ਵਰਗ ਦਾ ਬੱਚਾ ਸਿੱਖਿਆ ਪ੍ਰਾਪਤ ਕਰ ਸਕੇ ਅਤੇ ਪੈਸੇ ਦੀ ਕਮੀ ਦੇ ਕਾਰਨ ਕੋਈ ਵੀ ਸਿੱਖਿਆ ਦੇ ਹੱਕ ਤੋਂ ਵਾਂਝਾ ਨਾ ਰਹਿ ਸਕੇ ਪੰਜਾਬ ਸਰਕਾਰ ਦੁਆਰਾ ਨੋ ਡਿਟੈਂਸ਼ਨ ਪੋਲਿਸੀ ਵੀ ਚਲਾਈ ਜਾਂਦੀ ਹੈ ਜਿਸ ਦੇ ਤਹਿਤ ਅੱਠਵੀਂ ਜਮਾਤ ਤੱਕ ਕਿਸੇ ਵੀ ਬੱਚੇ ਨੂੰ ਫੇਲ ਨਹੀਂ ਕੀਤਾ ਜਾਂਦਾ ਤਾਂ ਜੋ ਉਹਨਾਂ ਦੇ ਹੌਸਲੇ ਹੋਰ ਬੁਲੰਦ ਰਹਿਣ ਅਤੇ ਉਹ ਉਚੇਰੀ ਸਿਖ ਸਿੱਖਿਆ ਦੇ ਲਈ ਅੱਗੇ ਵਧ ਸਕਣ